ਮੈਨੂੰ ਘੁੰਮਣ ਦਾ ਬਹੁਤ ਸ਼ੌਕ ਹੈ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚ ਮੈਂ ਘੁੰਮਿਆ ਹੈ ਪਰੰਤੂ ਅਮਰੀਕਾ ਇੱਕ ਅਜਿਹੀ ਸਟੇਟ ਹੈ ਜਿਸ ਨੂੰ ਯੂਨਾਈਟਡ ਸਟੇਟ ਵੀ ਕਿਹਾ ਜਾਂਦਾ ਹੈ ਮੇਰੇ ਉੱਥੇ ਦੋਸਤ ਰਹਿੰਦੇ ਹਨ ਜੋ ਮੈਨੂੰ ਅਕਸਰ ਹੀ ਸੱਦਾ ਦਿੰਦੇ ਹਨ ਵੀ ਤੁਸੀਂ ਇੱਥੇ ਆਉ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਵੀ ਇੱਥੇ ਆਉਣ ਦਾ ਕਾਰਨ ਕੀ ਹੈ ਤਾਂ ਉਹ ਮੈਨੂੰ ਦੱਸਦੇ ਹਨ ਸਾਰਿਆਂ ਨੂੰ ਪਹਿਲਾਂ ਬੰਦੇ ਦੀ ਹੈਲਥ ਫਿਰ ਇਨਸ਼ਿਓਰੈਂਸ ਫਿਰ ਮੈਡੀਕਲ ਇਹ ਤਿੰਨੇ ਚੀਜ਼ਾਂ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਨੇ ਉਸ ਤੋਂ ਬਾਅਦ ਜੋ ਸਟੱਡੀ ਹੈ ਸਟੱਡੀ ਵੀ ਉੱਥੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਏ ਟੂ ਜੈਡ ਫਰੀ ਹੈ ਮੈਡੀਕਲ ਸਹੂਲਤ ਬਿਲਕੁਲ ਫਰੀ ਹੈ ਉੱਥੇ ਦਾ ਰਹਿਣ ਸਹਿਣ ਵਾਤਾਵਰਨ ਅਤੇ ਤੁਹਾਡੀ ਸਿਹਤ ਲਈ ਬਹੁਤ ਹੀ ਸਰਕਾਰਾਂ ਬਹੁਤ ਵਧੀਆ ਕੰਮ ਕਰਦੀਆਂ ਹਨ ਜੋ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਮੇਰੇ ਦੋਸਤ ਮੈਨੂੰ ਹਰ ਵਾਰ ਇਹ ਕਹਿੰਦੇ ਹਨ ਵੀ ਤੁਸੀਂ ਉੱਥੇ ਆਉ ਤੁਹਾਨੂੰ ਹਰੇਕ ਚੀਜ਼ ਦਾ ਕਲੇਮ ਮਿਲੇਗਾ ਹਰੇਕ ਚੀਜ਼ ਤੁਹਾਡੀ ਕੋਈ ਨੁਕਸਾਨ ਨਹੀਂ ਕੋਈ ਚੋਰੀ ਨਹੀਂ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਬੇਈਮਾਨੀ ਨਹੀਂ ਜੋ ਰੂਲ ਇੱਕ ਪ੍ਰਧਾਨ ਮੰਤਰੀ ਲਈ ਉਹ ਇੱਕ ਆਮ ਇਨਸਾਨ ਲਈ ਰੂਲ ਹੈ ਮੇਰਾ ਮੰਨਣਾ ਇਹ ਹੈ ਕਿ ਅਜਿਹੇ ਦੇਸ਼ ਅਜਿਹੀ ਕੰਟਰੀ ਵਿੱਚ ਜਾਣ ਦਾ ਮੌਕਾ ਮਿਲੇ ਤਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਾਗਾਂ ਜੋ ਕਿ ਮੈਂ ਜਦੋਂ ਮੈਨੂੰ ਉਹ ਦੱਸਦੇ ਨੇ ਮੇਰਾ ਬਹੁਤ ਹੀ ਜੀਅ ਕਰਦਾ ਹੈ ਇਸ ਕਰਕੇ ਮੈਂ ਅਮਰੀਕਾ ਜਾਣਾ ਚਾਹੁੰਦਾ ਹਾਂ